ਹਾਂਜੀ ਪਿੱਛੇ ਹੀ ਇੰਟਰਨੈਟ ਉੱਤੇ ਔਨਲਾਈਨ ਚੀਜ਼ਾਂ ਦੀ ਅਤੇ ਇਲੈਕਟਰੋਨਿਕ ਚੀਜ਼ਾਂ ਦੀ ਸੇਲ ਚੱਲ ਰਹੀ ਤੀ ਅਤੇ ਮੈਂ ਅਤੇ ਮੇਰੇ ਦੋਸਤ ਬੈਠੇ ਵੈਸੇ ਹੀ ਉਸ ਨੂੰ ਦੇਖ ਰਹੇ ਸਨ ਅਤੇ ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਇਹ ਬਹੁਤ ਹੀ ਸਸਤੇ ਰੇਟ ਉੱਤੇ ਮਿਲ ਰਹੀ ਹੈ ਅਤੇ ਜਿਸ ਉੱਤੇ ਲਗਭਗ ਸੱਤਰ ਪਰਸੈਂਟ ਉੱਤੇ ਛੂਟ ਮਿਲ ਰਹੀ ਸੀ ਅਤੇ ਮੈਂ ਵੀ ਸੋਚਿਆ ਚਲੋ ਕੁਛ ਮੰਗਵਾ ਲੈਂਦੇ ਹਾਂ ਤਾਂ ਜੋ ਮੇਰਾ ਵੀ ਫਾਇਦਾ ਹੋ ਸਕੇ ਅਤੇ ਮੇਰੇ ਕੋਲ ਉਸ ਟਾਈਮ ਪੈਸੇ ਵੀ ਘੱਟ ਹੀ ਸਨ ਸੋ ਮੈਂ ਸੋਚਿਆ ਕਿ ਜਦੋਂ ਵੀ ਅਸੀਂ ਬਾਹਰ ਕਿਸੇ ਯਾਤਰਾ 'ਤੇ ਜਾਂਦੇ ਹਾਂ ਤਾਂ ਫੋਨ ਅਕਸਰ ਡੈਡ ਹੋ ਜਾਂਦਾ ਹੈ ਤਾਂ ਮੈਂ ਪਾਵਰ ਬੈਂਕ ਔਰਡਰ ਕਰ ਲਿਆ ਜੋ ਕਿ ਇੱਕ ਹਫ਼ਤੇ ਬਾਅਦ ਮੇਰੇ ਘਰ ਪਹੁੰਚ ਚੁੱਕਾ ਸੀ ਜਦੋਂ ਮੈਂ ਇਸ ਨੂੰ ਖੋਲ੍ਹਿਆ ਤਾਂ ਪਾਵਰ ਬੈਂਕ ਦੇਖਣ ਵਿੱਚ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਸੀ ਪਰ ਜਦੋਂ ਮੈਂ ਇਸ ਨੂੰ ਔਨ ਕੀਤਾ ਤਾਂ ਇਹ ਔਨ ਤਾਂ ਹੋ ਗਿਆ ਪਰ ਇਹ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ ਅਤੇ ਇਸ ਦੇ ਇਸ ਦ ਪਰ ਜਦੋਂ ਮੈਂ ਧਿਆਨ ਉੱਤੇ ਧਿਆਨ ਨਾਲ ਦੇਖਿਆ ਇਸ ਉੱਤੇ ਬਹੁਤ ਜ਼ਿਆਦਾ ਸਕਰੈਚ ਪਏ ਹੋਏ ਸਨ ਅਤੇ ਇਹ ਚੰਗੀ ਤਰਾਂ ਕੰਮ ਵੀ ਨਹੀਂ ਸੀ ਕਰ ਰਿਹਾ ਜਿਸ ਤੋਂ ਕਿ ਮੈਂ ਬਹੁਤ ਜ਼ਿਆਦਾ ਉਦਾਸ ਹੋਇਆ